ਵਿਚ ਬੱਚੇ ਬਹੁਤ ਹੀ ਬੇਫਿਕਰੀ ਦੇ ਨਾਲ ਖੇਡ ਰਹੇ ਸੀ ਇਹ ਤਸਵੀਰ ਮੈਂ ਬਹੁਤ ਆਪਣੇ ਮਨ ਦੇ ਨਾਲ ਬਿਨਾਂ ਕੁਛ ਸੋਚੇ ਸਮਝੇ ਬਣਾਈ ਜਿਸ ਵਿੱਚ ਕੋਈ ਬੱਚਾ ਖੇਡ ਰਿਹਾ ਸੀ ਕੋਈ ਕਿਤਾਬ ਪੜ੍ਹ ਰਿਹਾ ਸੀ ਅਤੇ ਕੋਈ ਆਪਣੇ ਆਪ ਵਿੱਚ ਹੀ ਬੈਠਾ ਸੀ ਇਹ ਤਸਵੀਰ ਮੈਂ ਬਣਾ ਦਿੱਤੀ ਪਰ ਜਦੋਂ ਮੈਂ ਅੱਜ ਇਹ ਤਸਵੀਰ ਵੇਖਦੀ ਹਾਂ ਤਾਂ ਮੈਨੂੰ ਅਹਿਸਾਸ ਹੁੰਦਾ ਹੈ ਕਿ ਅੱਜ ਕੱਲ੍ਹ ਦੇ ਬੱਚਿਆਂ ਦਾ ਬਚਪਨਾ ਕਿਤੇ ਖੋ ਹੀ ਗਿਆ ਹੈ ਜਿਸ ਨੂੰ ਅਸੀਂ ਬੱਚੇ ਨੂੰ ਦੋ ਢਾਈ ਸਾਲ ਦੀ ਉਮਰ ਵਿੱਚ ਹੀ ਸਕੂਲ ਭੇਜ ਰਹੇ ਹਾਂ ਜਿੱਥੇ ਬੱਚਾ ਸਿਰਫ ਗੁੰਮ ਸੁੰਮ ਹੋ ਕੇ ਬੈਠਣਾ ਹੀ ਸਿੱਖ ਰਿਹਾ ਹੈ ਉਸ ਤੋਂ ਬਾਅਦ ਮਾਪਿਆਂ ਦੀ ਜ਼ਿੰਦਗੀ ਇੰਨੀ ਵਿਅਸਤ ਹੋ ਚੁੱਕੀ ਹੈ ਕਿ ਉਹ ਬੱਚਿਆਂ ਨੂੰ ਸੰਭਾਲਣਾ ਆਪਣੀ ਬੜੀ ਹੀ ਮੁਸ਼ਕਿਲ ਸਮਝ ਰਹੇ ਹੈ ਆਪਣੇ ਲਈ ਅਤੇ ਉਹ ਆਪਣੇ ਬੱਚਿਆਂ ਨੂੰ ਮੋਬਾਇਲ ਦੇ ਕੇ ਬਿਠਾ ਰਹੇ ਹਨ ਵੀ ਤੁਸੀਂ ਆਪਣਾ ਖੇਡੋ ਅਤੇ ਅਸੀਂ ਆਪਣੇ ਕੰਮ ਵਿੱਚ ਵਿਅਸਤ ਹੋਈਏ ਸਾਨੂੰ ਕੋਈ ਪਰੇਸ਼ਾਨੀ ਨਾ ਹੋਵੇ ਅਤੇ ਜਦੋਂ ਮੈਂ ਇਹਨਾਂ ਬੱਚਿਆਂ ਨੂੰ ਮੋਬਾਇਲ ਵਿੱਚ ਰੁੱਝਿਆ ਵੇਖਦੀ ਹਾਂ ਤਾਂ ਮੈਨੂੰ ਬੜਾ ਬੁਰਾ ਅਹਿਸਾਸ ਹੁੰਦਾ ਹੈ ਕਿ ਇਹਨਾਂ ਬੱਚਿਆਂ ਦਾ ਬਚਪਨ ਕਿਤੇ ਖੋ ਗਿਆ ਹੈ ਅਤੇ ਮੇਰੇ ਤਸਵੀਰ ਵਾਲੇ ਬੱਚੇ ਵੀ ਕਿਤੇ ਖੋ ਗਏ ਹਨ ਕਿਉਂਕਿ ਇਹ ਖੇਡਣਾ ਹੱਸਣਾ ਤਾਂ ਬਿਲਕੁਲ ਹੀ ਭੁੱਲ ਚੁੱਕੇ ਹਨ ਅਤੇ ਮੈਨੂੰ ਬੜਾ ਹੀ ਇਹਨਾਂ ਬੱਚਿਆਂ ਬਾਰੇ ਬੁਰਾ ਮਹਿਸੂਸ ਹੁੰਦਾ ਹੈ